ਹੈਲੋ ਮੇਰਾ ਨਾਂ ਸਰੋਜ ਰਾਣੀ ਹੈ ਮੈਂ ਇਹ ਰਿਪੋਟ ਕਰਨ ਲਈ ਕਾਲ ਕਰ ਰਹੀ ਹਾਂ ਕਿ ਮੇਰਾ ਬੈਸਟ ਕੰਟੇਨਰ ਚੋਰੀ ਹੋ ਗਿਆ ਹੈ ਅਤੇ ਇਸ ਨੂੰ ਬਦਲਣ ਦੀ ਬੇਨਤੀ ਕਰਨੀ ਹੈ ਮੇਰਾ ਪਤਾ ਮੇਨ ਚੌਂਕ ਬਰਨਾਲਾ ਹੈ ਕੰਟੇਨਰ ਮਿਤੀ ਅਠਾਰ੍ਹਾਂ ਅੱਠ ਦੋ ਹਜ਼ਾਰ ਚੌਵੀ ਦੀ ਰਾਤ ਅਤੇ ਉੱਨੀ ਅੱਠ ਦੋ ਹਜ਼ਾਰ ਚੌਵੀ ਦੀ ਸਵੇਰ ਦੇ ਵਿਚਕਾਰ ਕਿਸੇ ਸਮੇਂ ਚੋਰੀ ਹੋ ਗਿਆ ਸੀ ਜਦੋਂ ਮੈਂ ਅੱਜ ਸਵੇਰੇ ਕੂੜਾ ਸੁੱਟਣ ਗਈ ਤਾਂ ਮੈਂ ਦੇਖਿਆ ਕਿ ਇਹ ਗਾਇਬ ਸੀ ਕੰਟੇਨਰ ਇੱਕ ਪੀਲੇ ਅਤੇ ਹਰੇ ਰੰਗ ਵਾਲਾ ਇੱਕ ਬਿਨ ਹੈ ਅਤੇ ਇਸਨੂੰ ਪਿਛਲੀ ਵਾਰ ਮੇਰੀ ਸੰਪਤੀ ਦੇ ਸਾਹਮਣੇ ਦੇਖਿਆ ਗਿਆ ਸੀ ਯਕੀਨਨ ਮੇਰਾ ਨੰਬਰ ਅਠਾਨਵੇਂ ਛਿਹੱਤਰ ਚੁਰੰਜਾ ਬੱਤੀ ਦਸ ਹੈ ਅਤੇ ਮੇਰਾ ਪਤਾ ਮਕਾਨ ਨੰਬਰ ਸਤਾਸੀ ਮੇਨ ਚੌਂਕ ਬਰਨਾਲਾ ਹੈ ਸੋ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੇ ਮੁਹੱਲੇ ਵਿੱਚ ਨਵਾਂ ਕੂੜੇਦਾਨ ਭੇਜਿਆ ਜਾਵੇ ਤਾਂ ਜੋ ਰਹਿੰਦ ਖੂੰਹਦ ਦਾ ਨਿਪਟਾਰਾ ਬਿਨਾ ਕਿਸੇ ਰੁਕਾਵਟ ਤੋਂ ਹੋ ਸਕੇ